ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੈਂ ਤੁਹਾਡੀ ਕੈਬ ਬੁੱਕ ਕਰਨ ਸੰਬੰਧੀ ਤੁਹਾਨੂੰ ਕਾਲ ਕੀਤੀ ਹੈ ਮੇਰੇ ਮਾਤਾ ਜੀ ਛੇ ਫੇਸ ਗੁਰੂ ਘਰ ਦੇ ਬਾਹਰ ਖੜ੍ਹੇ ਹਨ ਉਹਨਾਂ ਨੂੰ ਤੁਸੀਂ ਕੁਰਾਲੀ ਛੱਡਣਾ ਹੈ ਅਤੇ ਇਸ ਸੰਬੰਧੀ ਤੁਸੀਂ ਮੈਨੂੰ ਆਪਦਾ ਕਿਰਾਇਆ ਦੱਸ ਦਿਉ ਉਹਨਾਂ ਦਾ ਸੰਪਰਕ ਨੰਬਰ ਹੈ ਚੁਰਾਸੀ ਸਤਾਈ ਪਚਾਸੀ ਅਠਤਾਲੀ ਸਤਾਨਵੇਂ ਅਤੇ ਤੁਸੀਂ ਉਹਨਾਂ ਨੂੰ ਬਾਇਆ ਖਰੜ ਸਾਡੇ ਸ਼ਹਿਰ ਛੱਡਣਾ ਹੈ